ਹੈਲੋ ਹਾਂ ਤੇ ਨਵਨੀਤ ਵਧੀਆ ਵਧੀਆ ਤੂੰ ਦੱਸ ਹਾਂ ਸਾਰੇ ਵਧੀਆ ਠੀਕ ਠਾਕ ਤੂੰ ਸੁਣਾ ਆਪਣੇ ਹਾਂ ਰਿਜਲਟ ਆ ਗਿਆ ਕਿੰਨੇ ਪਰਸੈਂਟ ਹਾਂ ਦੇਖ ਲਿਆ ਕਿੰਨੇ ਪਰਸੈਂਟ ਬਣੇ ਤੇਰੇ ਮੇਰੇ ਵੀ ਇੰਨੇ ਵੀ ਏਟੀ ਫਾਈਵ ਬਣ ਗਏ ਹਾਂ ਵਧਾਈਆਂ ਹੋਣ ਤੈਨੂੰ ਵੀ ਪਾਰਟੀ ਕਰਾਂਗੇ ਤੂੰ ਦੱਸ ਤੂੰ ਕਦੋਂ ਦੇਣੀ ਹੈ ਤਾਂ ਫਿਰ ਕੀ ਹੋ ਗਿਆ ਇੱਕ ਬਰਾਬਰ ਹੀ ਹੈ ਤੇਰੇ ਵੀ ਤਾਂ ਅੱਸੀ ਪਰਸੈਂਟ ਆ ਗਏ ਹਾਂ ਬੀ ਬੀ ਐਸੀ ਕਰਨੀ ਹੈ ਦਸ ਕਿੱਥੇ ਕਰੀਏ ਅੱਛਾ ਠੀਕ ਅੱਛਾ ਠੀਕ ਹੈ ਕਿਵੇਂ ਕਾਲਜ ਤੈਨੂੰ ਪਤਾ ਕਿਵੇਂ ਵੀ ਇੱਥੇ ਟੀਚਰਸ ਵਗੈਰਾ ਕਿਵੇਂ ਐਡਮਿਸ਼ਨ ਦਾ ਕਿੰਨਾ ਕੁ ਵੀ ਆਪਣਾ ਹੋ ਸਕਦਾ ਹਾਂ ਠੀਕ ਹੈ ਜਾਵਾਂਗੇ ਫਿਰ ਦੇਖ ਲਾਂਗੇ ਆਪਾਂ ਬਸ ਪਾਸ ਵਗੈਰਾ ਬਣਵਾ ਲਾਂਗੇ ਨਹੀਂ ਤਾਂ ਆਪਾਂ ਘਰ ਸਕੂਟਰੀ ਦਾ ਕਰ ਲਾਂਗੇ ਅਤੇ ਆਪਾਂ ਨੂੰ ਜਾਣਾ ਸੌਖਾ ਹੋ ਜਾਵੇ ਵੀ ਬੱਸਾਂ ਦੇ ਵਿੱਚ ਵੀ ਤਾਂ ਵੇਟ ਕਰਨਾ ਹੀ ਪਊਗਾ ਆਪਾਂ ਨੂੰ ਹਾਂ ਵੈਨ 'ਤੇ ਵੀ ਸੋਖਾ ਹੋ ਜਾਵੇਗਾ ਹੋਰ ਬਾਕੀਆਂ ਦਾ ਕੀ ਬਣਿਆ ਹਾਂ ਆਪਾਂ ਬਾਕੀਆਂ ਨੂੰ ਵੀ ਪੁੱਛ ਲਾਂਗੇ ਜੇ ਕਿਸੇ ਨੇ ਕਰਨੀ ਹੈ ਤਾਂ ਆਪਾਂ ਇਕੱਠੇ ਫਿਰ ਵੈਨ ਦਾ ਪਤਾ ਕਰ ਲਾਂਗੇ ਜੇ ਆਪਾਂ ਪੰਜ ਛੇ ਕੁੜੀਆਂ ਹੋਈਆ ਤਾਂ ਫਿਰ ਵੈਨ ਦਾ ਕਰ ਲਾਂਗੇ ਵੈਨ ਦੀ ਇਕੱਠੀ ਫੀਸ ਭਰ ਲਿਆ ਕਰਾਂਗੇ ਹਾਂ ਅੱਛਾ ਵੀ ਟੀਚਰਸ ਵਗੈਰਾ ਵਧੀਆ ਉੱਥੇ ਵੀ ਵਧੀਆ ਕ ਕਰਾਉਂਦੇ ਆ ਵਧੀਆ ਸਮਝਾਉਂਦੇ ਹੈ ਅੱਛਾ ਇਕੱਲਾ ਕੁੜੀਆਂ ਦਾ ਹੀ ਹੈ ਹਾਂ ਫਿਰ ਤਾਂ ਵੈਨ ਵੂਨ ਲੱਗੀ ਹੋਊਗੀ ਆਪਾਂ ਵੈਨ ਦਾ ਹੀ ਪਤਾ ਕਰ ਲਾਂਗੇ ਹਾਂ ਹਾਂ ਘਰ ਸਲਾਹ ਕਰ ਆਜੀ ਤੂੰ ਘਰ ਆਜੀ ਫਿਰ ਆਪਾਂ ਵੀ ਬਾਕੀਆਂ ਨੂੰ ਵੀ ਲੈ ਆਈਂ ਤਾਂ ਆਪਾਂ ਘਰੇ ਬੈਠ ਕੇ ਆਪਾਂ ਸਲਾਹ ਕਰ ਲਾਂਗੇ ਹਾਂ ਫਿਰ ਉਹ ਹਿਸਾਬ ਨਾਲ ਦੇਖ ਲਾਂਗੇ ਆਪਾਂ ਵੀ ਕੀ ਕਰਨਾ ਕਿਵੇਂ ਜਾਣਾ ਆਉਣਾ ਸਹੀ ਫੀਸ ਵਗੈਰਾ ਕਾਲਜ ਦਾ ਵੀ ਪਤਾ ਕਰੇ ਆਵਾਂਗੇ ਆਪਾਂ ਠੀਕ ਆ ਹਾਂ ਹੋਰ ਕਾਲਜ ਦੇਖਲਾਂਗੇ ਇੱਥੇ ਵੀ ਕਹਿੰਦੇ ਆ ਨਾ ਵੀ ਬਠਿੰਡੇ ਵੀ ਹੈਗਾ ਜਿਵੇਂ ਬਾਬਾ ਫਰੀਦ ਹੋਊਗਾ ਇੱਧਰ ਵੀ ਬੀ ਐਸੀ ਵਗੈਰਾ ਕਰਾਵਾਉਂਦੇ ਆ ਸ਼ਾਇਦ ਬਾਕੀ ਉੱਧਰ ਉੱਧਰ ਵੀ ਆਪਾਂ ਹੈ ਨਾ ਫੋਨ ਨ ਫੋਨ 'ਤੇ ਪੁੱਛ ਲਾਂਗੇ ਜੇ ਜਾਣਾ ਹੈ ਤਾਂ ਆਪਾਂ ਹੈ ਨਾ ਫੋਨ 'ਤੇ ਪਤਾ ਕਰ ਲਾਂਗੇ ਵੀ ਵਗੈਰਾ ਕਿਵੇਂ ਹੈਗੇ ਨੇ ਅ ਮਿਲਦੇ ਹਾਂ ਫਿਰ ਦੇਖਦੇ ਆਪਾਂ ਤੂੰ ਆਜੀ ਕੋਈ ਨਾ ਠੀਕ ਓਕੇ